ਮੇਰੀ ਯਾਦਗਾਰ ਯਾਤਰਾ ਜੋ ਸੀ ਉਹ ਸ਼੍ਰੀ ਹੇਮਕੁੰਟ ਸਾਹਿਬ ਦੀ ਰਹੀ ਹੈ ਮੈਂ ਕਾਫੀ ਛੋਟੀ ਉਮਰ ਸੀ ਜਦੋਂ ਮੈਂ ਸ਼੍ਰੀ ਹੇਮਕੁੰਟ ਸਾਹਿਬ ਗਈ ਹਾਂ ਮੈਂ ਦਸ ਸਾਲਾਂ ਦੀ ਹੋਵਾਂਗੀ ਪਰ ਉੱਥੋਂ ਦੀ ਚੜ੍ਹਾਈ ਮੈਂ ਆਪ ਚੜ੍ਹਾਈ ਕੀਤੀ ਸੀ ਮੇਰੇ ਮੰਮੀ ਪਾਪਾ ਨੇ ਮੇਰੀ ਬੜੀ ਮਦਦ ਕੀਤੀ ਉੱਥੋਂ ਦੀ ਚੜ੍ਹਾਈ ਕਾਫੀ ਹੈ ਜ ਉੱਥੋਂ ਦਾ ਵਾਤਾਵਰਨ ਵੀ ਕਾਫੀ ਡਿਸਟਰਬਿੰਗ ਕਰਨ ਵਾਲਾ ਠੰਡ ਉੱਥੇ ਬਹੁਤ ਰਹਿੰਦੀ ਹੈ ਜਿਹਦੇ ਕਰਕੇ ਸਾਨੂੰ ਕੱਪੜੇ ਤਾਂ ਖੂਬ ਪਾਉਣੇ ਪੈਂਦੇ ਨੇ ਲੇਕਿਨ ਜਦੋਂ ਅਸੀਂ ਚੜ੍ਹਾਈ ਕਰਦੇ ਹਾਂ ਅਤੇ ਸਾਨੂੰ ਗਰਮੀ ਦੇ ਕਰਕੇ ਉਹ ਕੱਪੜੇ ਥੋੜ੍ਹੇ ਘਟਾਉਣੇ ਵੀ ਪੈ ਜਾਂਦੇ ਨੇ ਸਾਨੂੰ ਬੂਟ ਉੱਥੇ ਬੜੇ ਹਿਸਾਬ ਦੇ ਨਾਲ ਪਾਉਣੇ ਪੈਂਦੇ ਹੈ ਮੇਰਾ ਪੈਰ ਦਾ ਜੋ ਨੋਂਹ ਸੀ ਉਹ ਆਉਂਦੇ ਆਉਂਦੇ ਤਾਂ ਬਿਲਕੁਲ ਹੀ ਖਰਾਬ ਹੋ ਗਿਆ ਟੁੱਟ ਹੀ ਗਿਆ ਜਿਹਦੇ ਕਰਕੇ ਸਾਨੂੰ ਇੱਕ ਹਿਸਾਬ ਨਾਲ ਆਪਣੇ ਬੂਟਾਂ ਕੱਪੜਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਅਗਰ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਦੀ ਗੱਲ ਕਰੀਏ ਉੱਥੋਂ ਦਾ ਵਾਤਾਵਰਨ ਬਹੁਤ ਵਧੀਆ ਬਹੁਤ ਹੀ ਆਨੰਦਮਈ ਸੀ ਉਹ ਵਾਲੀ ਯਾਤਰਾ ਮੈਂ ਨੂੰ ਅਗਰ ਮੌਕਾ ਮਿਲੇ ਦੁਬਾਰਾ ਜਾਣ ਦਾ ਤਾਂ ਮੈਂ ਜ਼ਰੂਰ ਜਾਵਾਂਗੀ ਧੰਨਵਾਦ